ਭਾਰਤ ਦੇ ਵਿੱਚ ਜਿਹੜੇ ਤਾਂ ਹਿੰਦੂ ਲੋਕ ਹੈ ਉਹ ਤਿਰੂਪਤੀ ਬਾਲਾ ਜੀ ਸਾਲਾ ਸਰਧਾਮ ਅਯੋਧਿਆ ਆਦਿ ਮੰਦਰਾਂ ਵਿਖੇ ਜਾਂਦੇ ਹਨ ਅਤੇ ਜੋ ਆਪਣੇ ਸਿੱਖ ਲੋਕ ਹੈ ਉਹ ਹਜ਼ੂਰ ਸਾਹਿਬ ਫਤਿਹਗੜ੍ਹ ਸਾਹਿਬ ਪਟਨਾ ਸਾਹਿਬ ਇਹਨਾਂ ਗੁਰਦੁਆਰਿਆਂ 'ਤੇ ਜਾਣਾ ਜਾਣਾ ਅੱਛਾ ਸਮਝਦੇ ਹਨ ਅਤੇ ਜੇ ਆਪਾਂ ਗੱਲ ਕਰੀਏ ਫਤਿਹਗੜ੍ਹ ਸਾਹਿਬ ਇੱਥੇ ਸ਼ਹੀਦੀ ਜੋੜ ਮੇਲਾ ਲੱਗਦਾ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਦਿੱਤੀ ਸੀ ਉਹਨਾਂ ਦੀ ਮਾਤਾ ਜੀ ਦੀ ਸ਼ਹੀਦੀ ਇਸ ਇਹ ਸ਼ਹੀਦੀ ਦੇ ਕਰਕੇ ਉੱਥੇ ਪੂਰਾ ਹਫ਼ਤਾ ਹੀ ਬਹੁਤ ਵੱਡਾ ਮੇਲਾ ਲੱਗਦਾ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਜਗ੍ਹਾ ਜਗ੍ਹਾ 'ਤੇ ਲੰਗਰ ਲੱਗਦੇ ਹੈ ਜੇ ਆਪਾਂ ਦੇਖੀਏ ਪਟਿਆਲੇ ਤੋਂ ਸਰਹੰਦ ਤੱਕ ਸਾਰੀ ਜਗ੍ਹਾ 'ਤੇ ਲੰਗਰ ਹੀ ਲੰਗਰ ਲੱਗੇ ਹੁੰਦੇ ਹੈ ਅਤੇ ਪਟਿਆਲੇ ਵਿੱਚ ਲੋਕ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਵਿਖੇ ਜਾਣਾ ਵੀ ਬਹੁਤ ਪਸੰਦ ਕਰਦੇ ਹਨ ਇੱਥੇ ਵਿਸਾਖੀ ਵੇਲੇ ਬਹੁਤ ਹੀ ਵਧੀਆ ਵੱਡਾ ਮੇਲਾ ਲੱਗਦਾ ਅਤੇ ਨਾਲ ਹੀ ਪਟਿਆਲੇ ਦੇ ਵਿੱਚ ਗੁਰਦੁਆਰਾ ਬਹਾਦਰਗੜ੍ਹ ਵੀ ਹੈ ਜਿੱਥੇ ਕਿ ਮਾਘੀ ਵਿਸਾਖੀ ਆਦਿ ਦੇ ਮੇਲੇ ਬਹੁਤ ਹੀ ਵੱਡੇ ਜੋਰਾ ਸ਼ੋਰਾਂ ਨਾਲ ਲੱਗਦੇ ਹਨ